ਮੈਂ ਆਪਣੇ ਕਾਲਜ ਦੀ ਗੱਲ ਦੱਸਣਾ ਚਾਹੂੰਗਾ ਕਿ ਕਾਲਜ ਦੌਰਾਨ ਨਾ ਅਸੀਂ ਜਿਹੜੇ ਸਾਡੇ ਚਾਰ ਸਾਲ ਸੀਗੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕੋਲੇਜ ਦੇ ਵਿੱਚ ਉੱਥੇ ਨਾ ਅਸੀਂ ਬਣ ਪ੍ਰੋਗਰਾਮ ਬਣਾਉਂਦੇ ਰਹੇ ਵੀ ਅਸੀਂ ਨਾ ਇਕੱਲੇ ਘੁੰਮਣ ਜਾਵਾਂਗੇ ਵੀ ਕੋਲੇਜ ਵੱਲੋਂ ਨਹੀਂ ਜਾਵਾਂਗੇ ਛੁੱਟੀਆਂ ਦੌਰਾਨ ਨਾ ਜਿਵੇਂ ਗਰੁੱਪ ਦੇ ਵਿੱਚ ਜਾਵਾਂਗੇ ਅਤੇ ਭਾਈ ਹਰ ਸਾਲ ਪ੍ਰੋਗਰਾਮ ਬਣਦਾ ਲਿਤ 'ਤੇ ਐਂਡ 'ਤੇ ਉਹ ਪੂਰਾ ਨਾ ਚੜ੍ਹਦਾ ਕੋਈ ਮੁੱਕਰ ਜਾਂਦੇ ਬਾਅਦ 'ਚ ਨਾ ਅਤੇ ਜਦੋਂ ਸਾਡਾ ਅਖੀਰਲਾ ਸਾਲ ਆ ਗਿਆ ਅਤੇ ਮੈਂ ਕਿਹਾ ਵੀ ਆਪਾਂ ਇਸ ਵਾਰ ਕਿਤੇ ਜਾਣਾ ਜ਼ਰੂਰ ਵੀ ਆਪਾਂ ਹਰ ਸਾਲ ਪ੍ਰੋਗਰਾਮ ਬਣਾਉਂਦੇ ਹਾਂ ਪਰ ਆਪਾਂ ਜਾਂਦੇ ਕਿਤੇ ਨਹੀਂ ਫਿਰ ਅਸੀਂ ਨਾ ਕੋਈ ਕਹਿੰਦਾ ਵੀ ਉੱਥੇ ਚਲੋ ਉੱਥੇ ਚਲੋ ਕਰਦੇ ਕਰਦੇ ਅਸੀਂ ਤਿੰਨ ਜਣੇ ਰਹਿ ਗਏ ਅਤੇ ਅਸੀਂ ਫਿਰ ਗਏ ਸੀ ਮਨਾਲੀ ਅਸੀਂ ਗਏ ਸੀ ਮਨਾਲੀ ਅਤੇ ਆਪਣਾ ਮਨੀਕਰਨ ਸਾਹਿਬ ਪਹਿਲਾਂ ਅਸੀਂ ਮਨੀਕਰਨ ਸਾਹਿਬ ਗਏ ਉੱਥੇ ਇੱਕ ਰਾਤ ਰਹੇ ਅਤੇ ਗੁਰਦੁਆਰੇ ਦੇ ਵਿੱਚ ਉੱਥੇ ਫਿਰ ਉਸ ਤੋਂ ਬਾਅਦ ਅਸੀਂ ਅਗਲੇ ਦਿਨ ਇੱਕ ਹੋਟਲ 'ਚ ਰਹੇ ਉੱਥੇ ਮਨੀਕਰਨ ਸਾਹਿਬ ਅਤੇ ਉਸ ਤੋਂ ਬਾਅਦ ਅਸੀਂ ਫਿਰ ਇੱਥੇ ਮਨਾਲੀ ਆ ਗਏ ਅਤੇ ਮਨਾਲੀ ਇੱਕ ਰਾਤ ਉੱਥੇ ਸਟੇਅ ਕੀਤੀ ਅਤੇ ਉੱਥੋਂ ਫਿਰ ਵਾਪਸ ਅਸੀਂ ਆਪਣੇ ਘਰ ਆ ਗਏ ਇਹ ਅਸੀਂ ਜਿਹੜੇ ਤਿੰਨ ਜਾਣੇ ਗਏ ਸੀ ਜਾਣੀ ਇਹ ਮੈਨੂੰ ਭੁੱਲਦਾ ਨਹੀਂ ਹੈਗਾ ਜੋ ਉਸ ਉਸ ਤੋਂ ਬਾਅਦ ਕਿਉਂਕਿ ਸਾਰੇ ਵਿਛੜ ਗਏ ਅਲੱਗ ਅਲੱਗ ਜਗ੍ਹਾ 'ਤੇ ਆਪੋ ਆਪਣੇ ਕੰਮਾਂ ਕਾਰਾਂ 'ਚ ਲੱਗ ਗਏ ਅਤੇ ਇਹ ਬਹੁਤ ਵਧੀਆ ਟ੍ਰਿਪ ਰਿਹਾ ਸੀਗਾ ਮਨਾਲੀ ਦਾ ਅਤੇ ਬਹੁਤ ਜਿਹੜੇ ਉੱਥੇ ਕਹਿੰਦੇ ਆ ਗਰਮ ਪਾਣੀ ਦੇ ਚਸ਼ਮੇ ਸੀਗੇ ਮਨੀਕਰਨ ਸਾਹਿਬ ਜਿਹੜੇ ਸਭ ਤੋਂ ਵਧੀਆ ਲੱਗੇ ਸਾਨੂੰ ਕਿ ਇੱਕ ਵਾਰ ਵਿੱਚ ਵੜ ਕੇ ਨਾ ਬੰਦੇ ਨੂੰ ਬਾਹ ਪਹਿਲਾਂ ਡਰ ਲੱਗਦਾ ਵੀ ਇਹ ਗਰਮ ਪਾਣੀ 'ਚ ਕਿੰਨਾ ਤੇਜ਼ ਹੈ ਵੀ ਨਾ ਉਸ ਤੋਂ ਬਾਅਦ ਬਹੁਤ ਬਹੁਤ ਵਧੀਆ ਲੱਗਦਾ ਕਿ ਐਨ ਪੂਰੇ ਰਿਲੈਕਸ ਹੋ ਜਾਂਦੀ ਆ ਬੋਡੀ ਐਨ ਥਕਾਵਟ ਦੂਰ ਹੋ ਜਾਂਦੀ ਆ ਇਸ ਕਰਕੇ ਮੈਨੂੰ ਇਹ ਯਾਤਰਾ ਨਹੀਂ ਭੁੱਲਦੀ ਹੈਗੀ